ਪੰਜਾਬੀ ਭਾਸ਼ਾ ਮੇਰੇ ਹਿਸਾਬ ਨਾਲ ਤਾਂ ਦੇਖੋ ਪੰਜਾਬ ਦੀ ਜਿਹੜੀ ਪੰਜਾਬੀ ਭਾਸ਼ਾ ਹੈ ਨਾ ਉਹ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਸੱਭਿਆਚਾਰਕ ਵਟਾਂਦਰੇ ਅਤੇ ਸੰਚਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪੰਜਾਬੀ ਭਾਸ਼ਾ ਇੱਕ ਕਹਿ ਲਓ ਕਿ ਬਹੁਤ ਹੀ ਮਿੱਠੀ ਅਤੇ ਆਪਣੇ ਆਪ ਆਪਣੇਪਣ ਵਾਲੀ ਭਾਸ਼ਾ ਹੈ ਇਹਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣਾਪਣ ਜਤਾ ਸਕਦੇ ਹੋ ਆਪਣਾ ਛੇਤੀ ਬਣਾ ਸਕਦੇ ਹੋ ਕਿਸੇ ਕੋਲੋਂ ਕੋਈ ਕੰਮ ਨਿਕਲਵਾਉਣਾ ਹੋਵੇ ਤਾਂ ਇਹ ਭਾਸ਼ਾ ਬੜੀ ਮਿੱਠੀ ਲੱਗਦੀ ਆ ਇਹਨਾਂ ਦਾ ਇਹ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਨਾ ਉਹ ਸੱਭਿਆਚਾਰਕ ਵਟਾਂਦਰੇ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਗਿੱਧੇ ਭੰਗੜਾ ਹੁਣ ਤਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਟੀ ਵੀ ਸਟਾਰਸ ਵੀ ਪੰਜਾਬੀ ਗਾਣੇ ਵੱਡੇ ਵੱਡੇ ਸਟਾਰ ਵੀ ਗਾਉਣ ਲੱਗ ਗਏ ਆ ਹੁਣ ਮੰਨ ਲਓ ਕਿ ਅਸੀਂ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਗਰਬਾ ਹੁੰਦਾ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਭੰਗੜਾ ਬੜਾ ਮਸ਼ਹੂਰ ਹੈਗਾ ਅਤੇ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਆਪਣਾ ਭੰਗੜਾ ਸਿਖਾਈਏ ਉਹਨਾਂ ਕੋਲੋਂ ਅਸੀਂ ਗਰਬਾ ਸਿੱਖੀਏ ਅਤੇ ਇੱਕ ਤਰ੍ਹਾਂ ਦਾ ਇਹ ਸੱਭਿਆਚਾਰਕ ਵਟਾਂਦਰਾ ਹੀ ਹੋ ਗਿਆ ਨਾ ਅਤੇ ਜੋ ਕਿ ਸਾਨੂੰ ਆਪਣੇਪਣ ਲੱਗਦਾ ਹੈ ਇਹਨਾਂ ਦੇ ਵਿੱਚ ਬਹੁਤ ਸਾਰਾ